ਜੇਕਰ ਗੱਲ ਵਹਿਮਾਂ ਭਰਮਾਂ ਦੀ ਕਰੀਏ ਤਾਂ ਪਿੰਡ ਵਿੱਚ ਪਿੰਡ ਦੇ ਲੋਕ ਅੱਜ ਕੱਲ੍ਹ ਵੀ ਇਸ ਚੀਜ਼ ਨੂੰ ਮੰਨਦੇ ਨੇ ਅਤੇ ਪੂਰੇ ਵਿਸ਼ਵਾਸ ਨਾਲ ਮੰਨਦੇ ਨੇ ਜਿਵੇਂ ਉਹ ਮੰਨਦੇ ਨੇ ਜਿਵੇਂ ਅਸੀਂ ਕਿਸੇ ਨਵੇਂ ਘਰ ਦੇ ਵਿੱਚ ਜਾਂਦੇ ਹਾਂ ਤਾਂ ਉਹ ਜਿਹੜਾ ਘਰ ਹੁੰਦਾ ਏ ਆ ਬੰਦ ਪਿਆ ਹੁੰਦਾ ਆ ਅਤੇ ਉਹ ਬਹੁਤ ਵਿਸ਼ਵਾਸ ਨਾਲ ਕਹਿੰਦੇ ਨੇ ਕਿ ਜਦੋਂ ਆਪਾਂ ਘਰ ਦੇ ਵਿੱਚ ਘਰ ਪ੍ਰਵੇਸ਼ ਕਰਦੇ ਹਾਂ ਤਾਂ ਸਾਨੂੰ ਪੂਜਾ ਪਾਠ ਕਰਕੇ ਹੀ ਘਰ ਦੇ ਅੰਦਰ ਜਾਣਾ ਚਾਹੀਦਾ ਆ ਜ ਤਾਂ ਇਸ ਇਸ ਮੱਤ ਦੇ ਉੱਤੇ ਉਹ ਬਹੁਤ ਯਕੀਨ ਰੱਖਦੇ ਨੇ ਅਤੇ ਅਗਰ ਆਪਾਂ ਦੂਸਰੇ ਤਰੀਕੇ ਨਾਲ ਵਿਗਿਆਨਿਕ ਤੌਰ 'ਤੇ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਇਹਦਾ ਇੱਕ ਸੈਂਟੀਫਿਕ ਕਾਰਨ ਵੀ ਆ ਕਿਉਂਕਿ ਜਦੋਂ ਘਰ ਬੰਦ ਹੁੰਦਾ ਏ ਆ ਤਾਂ ਉਹਦੇ ਵਿੱਚ ਬਹੁਤ ਸਾਰੇ ਕੀਟਾਣੂ ਜਿਹੜੇ ਹੋ ਜਾਂਦੇ ਨੇ ਅਤੇ ਉਹ ਹਵਨ ਦੇ ਧੂੰਏ ਨਾਲ ਉਹ ਕੀਟਾਣੂ ਜਿਹੜੇ ਆ ਮਰ ਜਾਂਦੇ ਨੇ ਤਾਂ ਅਗਰ ਆਪਾਂ ਸੈਂਟੀਫਿਕ ਤੌਰ 'ਤੇ ਵੀ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਇਹ ਵੀ ਇੱਕ ਵਜ੍ਹਾ ਹੈਗੀ ਆ ਕਿ ਵਿਸ਼ਵਾਸ ਕਰਨਾ ਵਿਸ਼ਵਾਸ ਕਰਦੇ ਨੇ ਲੋਕ ਇਸ ਚੀਜ਼ 'ਤੇ